ਹਾਂ ਕਿ ਮੈਂ ਆਪਣੀ ਨਾ ਸਾਈਕਲ 'ਤੇ ਬਹੁਤ ਸਾਰੇ ਚੁਣੌਤੀਪੂਰਨ ਜਿਹੜੇ ਟਾਸਕ ਹੁੰਦੇ ਉਹ ਪੂਰੇ ਕੀਤੇ ਆ ਜਿੱਦਾਂ ਕਿ ਮੈਂ ਬਹੁਤ ਪਹਾੜੀ ਇਲਾਕਿਆਂ 'ਚ ਗਿਆ ਸਾਈਕਲ 'ਤੇ ਮੈਂ ਇੱਥੋਂ ਆਪਣੇ ਅੰਮ੍ਰਿਤਸਰ ਤੋਂ ਤਰਨਤਾਰਨ ਵੀ ਬਹੁਤ ਵਾਰ ਸਾਈਕਲ 'ਤੇ ਗਿਆ ਹਾਂ ਜਾਂਦਾ ਵੀ ਰਹਿੰਦਾ ਸਕੂਲ ਜਾਂਦਾ ਹਾਂ ਹੁਣ ਕਿੱਦਾਂ ਧੁੰਦ ਬਹੁਤ ਪੈਂਦੀ ਹੈ ਤਾਂ ਸਾਈਕਲ 'ਤੇ ਜਾਣਾ ਬਹੁਤ ਔਖਾ ਵਾ ਕਿ ਆਪਾਂ ਨੂੰ ਠੰਡ ਤੁਹਾਨੂੰ ਪਤਾ ਬਹੁਤ ਜ਼ਿਆਦਾ ਕੜਾਕੇ ਦੀ ਧੁੰਦ ਆ ਅਤੇ ਆਪਣੀ ਕਿਹੜੀ ਸਾਈਕਲ 'ਤੇ ਜਾਣਾ ਬਹੁਤ ਔਖਾ ਹੁੰਦਾ ਵਾ ਅਤੇ ਆਪਣੇ ਸਾਈਕਲ ਚਲਾਉਣੀ ਸਿਹਤ ਵੀ ਇੱਕ ਇੱਕ ਪ੍ਰਕਾਰ ਨਾਲ ਆਪਣੇ ਲਈ ਸਾਈਕਲ ਆ ਕਿਹੜੀ ਉਹ ਸਿਹਤ ਲਈ ਵੀ ਬਹੁਤ ਚੰਗੀ ਆ ਆਪਣੇ ਕਿਹੜੇ ਪੁਰਾਣੇ ਭਾਪੇ ਦਾਦਾ ਦਾਦੇ ਨਾਨੇ ਸੀ ਉਹ ਸਾਈਕਲ ਚਲਾਉਂਦੇ ਸੀ ਅਤੇ ਉਹਨਾਂ ਦੇ ਗੋਡੇ ਬਹੁਤ ਵਧੀਆ ਹੁੰਦੇ ਸੀ ਉਹ ਤੁਰਨ ਫਿਰਨ 'ਚ ਵੀ ਵਧੀਆ ਹੁੰਦੇ ਸੀ ਉਹ ਸਾਈਕਲ 'ਚ ਬਹੁਤ ਲੰਮ ਦੂਰ ਦੂਰ ਤੱਕ ਜਾਂਦੇ ਸੀ ਮੇਰੇ ਦਾਦਾ ਜੀ ਆ ਉਹ ਹੁਣ ਸਾਈਕਲ ਤੋਂ ਤਰਨ ਤਾਰਨ ਤੋਂ ਅੰਮ੍ਰਿਤਸਰ ਆ ਜਾਂਦੇ ਆ ਤੋ ਸਾਈਕਲ 'ਤੇ ਹੀ ਅਤੇ ਉਸ ਸਾਈਕਲ 'ਤੇ ਬਹੁਤ ਦੂਰ ਦੂਰ ਤੱਕ ਗਏ ਆ ਅਤੇ ਸਾਈਕਲ ਆ ਜਿਹੜੀ ਉਹ ਆਪਾਂ ਨੂੰ ਸਿਹਤ ਵਜੋਂ ਵੀ ਅਤੇ ਉੱਦਾਂ ਵੀ ਚੰਗੀ ਆ ਉਹਦੇ ਨਾਲ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਅਤੇ ਸਾਇਕਲ 'ਤੇ ਮੈਂ ਆਪਣਾ ਆਨੰਦਪੁਰ ਸਾਹਿਬ ਵੀ ਗਿਆ ਹਾਂ ਇੱਕ ਵਾਰ ਅਤੇ ਬਹੁਤ ਸਾਰੀਆਂ ਜਗ੍ਹਾ 'ਤੇ ਗਿਆ ਹੋਰ ਵੀ ਮੇਰੇ ਕੋਲ ਵੀ ਇੱਕ ਸਾਈਕਲ ਹੈਗੀ ਆ ਉਹਦਾ ਕਲਰ ਬਲੈਕ ਜੈਡ ਆ ਅਤੇ ਉਹਨੂੰ ਮੈਂ ਬਹੁਤ ਸਾਂਭ ਕੇ ਰੱਖਿਆ ਵਾ ਉਹ ਮੈਨੂੰ ਪਹਿਲੀ ਸਾਈਕਲ ਮੈਨੂੰ ਮੇਰੇ ਮੰਮਾ ਨੇ ਗਿਫਟ ਕੀਤੀ ਸੀ ਅਤੇ ਹੁਣ ਅੱਜ ਕੱਲ੍ਹ ਤਾਂ ਬਹੁਤ ਸਾਰੀਆਂ ਸਾਈਕਲਾਂ ਜਿੱਦਾਂ ਗੇਅਰਾਂ ਵਾਲੀ ਸਾਈਕਲ ਹੋ ਗਈ ਰੇਂਜਲ ਹੋ ਗਏ ਰੈਮ ਓ ਹੋਰ ਜੀ ਦੋ ਤਿੰਨ ਪ੍ਰਕਾਰ ਦੀਆਂ ਸਾਈਕਲਾਂ ਹੁੰਦੀਆਂ ਸਭ ਸਾਈਕਲਾਂ ਬਹੁਤ ਵਧੀਆ ਹੁੰਦੀਆਂ